ਹੈਲੋ ਸਤਿ ਸ਼੍ਰੀ ਅਕਾਲ ਜੀ ਸੁਣਾਓ ਕੀ ਹਾਲ ਚਾਲ ਆ ਹਾਂਜੀ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂ ਹਾਂਜੀ ਠੀਕ ਤਾਂ ਹੈਗਾ ਭੈਣ ਜੀ ਪਰ ਨਾ ਟਰੈਫ਼ਿਕ ਬਹੁਤ ਆ ਇੱਥੇ ਸ਼ਹਿਰ ਅਤੇ ਉਹ ਹਾਰਨ ਹੂਰਨ ਜਿਹੇ ਬੜੇ ਵੱਜਦੇ ਰਹਿੰਦੇ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਠੀਕ ਹੈ ਸ਼ਾਮੀ ਮਿਲਾਂਗੇ ਸੱਤ ਵਜੇ ਨੂੰ ਹਾਂਜੀ ਹਾਂਜੀ ਹੋਰ ਚਲੋ ਠੀਕ ਠਾਕ ਚਲੋ ਠੀਕ ਆ ਹਾਂਜੀ ਓਕੇ ਬਾਏ